ਜਿਹੜੇ ਬੈਂਕਿੰਗ ਅਤੇ ਬੀਮਾ ਸਾਡੇ ਲੈਣ ਦੇਣ ਦੇ ਭੁਗਤਾਨ ਨੂੰ ਸੰਭਾਲਣ ਦੇ ਤਰੀਕੇ ਬਦਲ ਰਹੇ ਹਨ ਉਹ ਇਸ ਤਰ੍ਹਾਂ ਹਨ ਕਿ ਜਿਵੇਂ ਸਾਨੂੰ ਪਹਿਲਾਂ ਕੀ ਹੁੰਦਾ ਸੀ ਜਿਹੜੀਆਂ ਸਾਨੂੰ ਬੈਂਕਾਂ ਤੋਂ ਸੁਵਿਧਾਵਾਂ ਮਿਲਦੀਆਂ ਸਨ ਉਹਦੇ ਵਿੱਚ ਸਾਨੂੰ ਬੈਂਕ ਜਾ ਕੇ ਸਾਰੇ ਕਾਰਜ ਕਰਨੇ ਪੈਂਦੇ ਸੀ ਭਾਵੇਂ ਉਹ ਅਸੀਂ ਪੈਸੇ ਜਮ੍ਹਾਂ ਕਰਵਾਉਣੇ ਨੇ ਜਾਂ ਪੈਸੇ ਕਢਵਾਉਣੇ ਨੇ ਪਰ ਅਜੋਕੇ ਯੁੱਗ ਵਿੱਚ ਸਾਨੂੰ ਸਾਡੇ ਏਟੀਐਮ ਕਾਰਡ ਮਿਲਦੇ ਨੇ ਜਿਸ ਰਾਹੀਂ ਆਪਾਂ ਕਿਧਰੇ ਵੀ ਕਿਸੇ ਵੀ ਸਮੇਂ ਜਾ ਕੇ ਏਟੀਐਮ ਤੋਂ ਪੈਸੇ ਨਿਕਲਵਾ ਸਕਦੇ ਹਾਂ ਧੰਨਵਾਦ